ਖੇਡਾਂ ਪੇਂਡੂ ਲੋਕਾਂ ਦੀਆਂ ਮੁੱਖ ਜੀਵਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਪੁਰਾਤਨ ਸਮਿਆਂ ਤੋਂ ਖੇਡਾਂ ਚਲੀਆਂ ਆ ਰਹੀਆਂ ਹਨ ਲੋਕ ਆਪਣੇ ਮਨੋਰੰਜਨ ਵਿੱਚ ਇਹਨਾਂ ਦਾ ਬਹੁਤ ਯੂਜ਼ ਕਰਦੇ ਸਨ ਕਿਉਂਕਿ ਖੇਡਾਂ ਇਕੱਲੀ ਕੇਵਲ ਦੇਖਣ ਦਾ ਖੇਡ ਨਹੀਂ ਹੈ ਅਤੇ ਇਹਦੇ ਨਾਲ ਬੰਦਾ ਆਪਣੇ ਆਪ ਨੂੰ ਵੀ ਇਸ ਚੀਜ਼ 'ਚ ਪਾਉਣ ਬਾਰੇ ਸੋਚਦਾ ਹੈ ਕਿ ਮੈਂ ਵੀ ਇਹ ਚੀਜ਼ ਕਰਾਂ ਬੰਦੇ ਨੂੰ ਇਹ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ ਕਈ ਨੌਜਵਾਨ ਪੀੜ੍ਹੀਆਂ ਨੂੰ ਇਸ 'ਚ ਖੇਡਾਂ ਨੇ ਨਸ਼ਿਆਂ ਤੋਂ ਵੀ ਬਚਾਇਆ ਹੈ ਮੇਨਲੀ ਕਿਉਂਕਿ ਪਿੰਡਾਂ ਦੇ ਵਿੱਚ ਖੇਡੀ ਜਾਣ ਵਾਲੀ ਖੇਡ ਹੈਗੀ ਹੈ ਕਬੱਡੀ ਜਾਂ ਭਲਵਾਨੀ ਕੁਸ਼ਤੀ ਇਹ ਸਿਰਫ ਜ਼ੋਰ ਦੀ ਖੇਡ ਹੈ ਇਹ ਕੋਈ ਹੋਰ ਨਹੀਂ ਜ਼ੋਰ ਅਤੇ ਦਿਮਾਗ ਦੀ ਖੇਡ ਹੈ ਜੋ ਕਿ ਅੱਜ ਕੱਲ੍ਹ ਲੋਕਾਂ ਵਿੱਚ ਵਰਤੀ ਜਾਂਦੀ ਕਿਉਂਕਿ ਅੱਜ ਕੱਲ੍ਹ ਆਹ ਆਪਣੀ ਪੀੜ੍ਹੀ ਸਾਰੀ ਨਸ਼ਿਆਂ ਦੇ ਵਿੱਚ ਵੜੀ ਹੋਈ ਹੈ ਕੋਈ ਖੇਡ ਵੱਲ ਜ਼ਿਆਦਾ ਫੋਕੱਸ ਨਹੀਂ ਕਰਦਾ ਅੱਜ ਕੱਲ੍ਹ ਜੋ ਵੀ ਕੋਈ ਜੋਬ ਮਿਲਦੀ ਹੈ ਜਾਂ ਸਰਕਾਰੀ ਜੋਬ ਮਿਲਦੀ ਹੈ ਮਿਲਦੀ ਜ਼ਿਆਦਾ ਸਪੋਰਟਸ ਕੋਟੇ ਵਾਲਿਆ ਨੂੰ ਹੈ ਉਂਝ ਤਾਂ ਕੋਈ ਕਿਸੇ ਨੂੰ ਕੋਈ ਜੋਬ ਨਹੀ ਦਿੰਦਾ ਹੈਗਾ ਕਿਉਂਕਿ ਪਿੰਡ ਵਾਲੇ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਸਪੋਰਟਸ ਨੂੰ ਉਹ ਕਰ ਰਹੇ ਨੇ ਖੇਡਾਂ ਨੂੰ ਪ੍ਰਮੋਟ ਕਰ ਰਹੇ ਨੇ ਕਿਉਂਕਿ ਅੱਜ ਵੀ ਪਿੰਡਾਂ ਦੇ ਲੋਕਾਂ ਨੇ ਆਪਣਾ ਵਿਰਸਾ ਸਾਂਭ ਕੇ ਰੱਖਿਆ ਹੈ ਕਬੱਡੀ ਅਤੇ ਕੁਸ਼ਤੀ ਇਹਨਾਂ ਚੀਜ਼ਾਂ ਨੂੰ ਪੇਂਡੂ ਲੋਕ ਪ੍ਰਮੋਟ ਕਰ ਰਹੇ ਨੇ ਕਿਉਂਕਿ ਗੇਮਾਂ ਵਿੱਚ ਹੈ ਹੀ ਜ਼ਿਆਦਾ ਪੇਂਡੂ ਲੋਕ ਨੇ